ਭਾਸ਼ਾ ਹਿੰਦੀ ਭਾਸ਼ਾ ਇੱਕ ਰਾਸ਼ਟਰੀ ਭਾਸ਼ਾ ਹੈ ਜੋ ਕਿ ਆਮ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ ਜਿਸ ਦੀ ਸਾਰੇ ਹਿੰਦੁਸਤਾਨ ਦੇ ਵਿੱਚ ਸਮਝ ਆ ਜਾਂਦੀ ਹੈ ਇਸ ਕਰਕੇ ਪੰਜਾਬੀ ਇਹ ਪੰਜਾਬ ਦੇ ਵਿੱਚ ਹੀ ਸਾਰੇ ਪੰਜਾਬੀ ਲੋਕਾਂ ਨੂੰ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ ਔਰ ਹਿੰਦੀ ਭਾਸ਼ਾ ਜੋ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਪੜ੍ਹਾਈ ਜਾਂਦੀ ਹੈ ਜਿਸ ਦੇ ਨਾਲ ਇਹ ਰਾਸ਼ਟਰੀ ਭਾਸ਼ਾ ਹੈ ਜਿਸ ਦੇ ਪੰਜਾਬੀ ਦੇ ਬਰਾਬਰ ਪੰਜਾਬੀ ਪੰਜਾਬ ਵਿੱਚ ਹੀ ਜ਼ਿਆਦਾਤਰ ਲੋਕ ਪੜ੍ਹਦੇ ਹਨ ਅਤੇ ਪੰਜਾਬ ਵਿੱਚ ਹੀ ਜ਼ਿਆਦਾ ਇਸ ਦੀ ਕੰਮ ਕਰਦੇ ਹਨ ਪੰਜਾਬੀ ਜੋ ਕਿ ਪੰਜਾਬ ਵਿੱਚ ਦਫਤਰਾਂ ਦੇ ਵਿੱਚ ਵੀ ਔਰ ਹਿੰਦੀ ਭਾਸ਼ਾ ਪਹਿਲੇ ਨੰਬਰ 'ਤੇ ਹੈ ਹਿੰਦੁਸਤਾਨ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਬੱਚਿਆਂ ਨੂੰ ਬਹੁਤ ਇੰਟਰਸਟ ਨਾਲ ਪੜ੍ਹਾਈ ਜਾਂਦੀ ਹੈ